ਸਾਡੇ ਸਟੇਟ ਵਿੱਚ ਟਰਾਂਸਪੋਰਟ ਦੀ ਕੁਆਲਿਟੀ ਨਾ ਤਾਂ ਬਹੁਤ ਚੰਗੀ ਹੈ ਅਤੇ ਨਾ ਹੀ ਬਹੁਤ ਮਾੜੀ ਇਹ ਮੈਂ ਇਸ ਲਈ ਕਹਿ ਰਿਹਾ ਕਿਉਂ ਕਰਕੇ ਕਈ ਟਰਾਂਸਪੋਰਟ ਦੇ ਸਾਧਨ ਕਾਫੀ ਚੰਗੇ ਮਿਲ ਜਾਂਦੇ ਹਨ ਅਤੇ ਕਈ ਟਰਾਂਸਪੋਰਟ ਦੇ ਸਾਧਨ ਕਾਫੀ ਖਸਤਾ ਹਾਲਤ ਦੇ ਵਿੱਚ ਮਿਲਦੇ ਹਨ ਟਰਾਂਸਪੋਰਟ ਦਾ ਉਂਝ ਇੱਕ ਥਾਂ ਤੋਂ ਦੂਜੇ ਥਾਵੇਂ ਜਾਣ ਦਾ ਖਰਚਾ ਮਰਦਾਂ ਲਈ ਕਾਫੀ ਜ਼ਿਆਦਾ ਹੈ ਜਦੋਂ ਕਿ ਔਰਤਾਂ ਦੇ ਲਈ ਬੱਸਾਂ ਦਾ ਸਫ਼ਰ ਹੈ ਜਿਹੜਾ ਉਹ ਸਾਡੀ ਸਟੇਟ ਦੇ ਵਿੱਚ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਜੋ ਕਿ ਮਰਦਾਂ ਦੇ ਨਾਲ ਬੇਇਨਸਾਫੀ ਸਮਝੀ ਜਾ ਸਕਦੀ ਹੈ ਅਤੇ ਟਰਾਂਸਪੋਰਟ ਨੂੰ ਵੀ ਡੁਬੋਣ ਵਾਲੀ ਗੱਲ ਹੈ ਅਤੇ ਇਸ ਦਾ ਇੱਕ ਪ੍ਰਭਾਵ ਇਹ ਵੀ ਪੈਂਦਾ ਹੈ ਕਿ ਬੱਸਾਂ ਦੇ ਵਿੱਚ ਔਰਤਾਂ ਦੀ ਜਿਹੜੀ ਭੀੜ ਭੜੱਕਾ ਹੈ ਉਹ ਬਹੁਤ ਜ਼ਿਆਦਾ ਰਹਿੰਦਾ ਹੈ ਅਤੇ ਕਈ ਥਾਂ ਵੀ ਕੰਡਕਟਰਾਂ ਦੇ ਨਾਲ ਉਹਨਾਂ ਦੀ ਲੜਾਈ ਦੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਹਨ ਭਾਰਤ ਦੇ ਵਿੱਚ ਯਾਤਰਾ ਹੈ ਜਿਹੜੀ ਉਹ ਕਾਫੀ ਮਹਿੰਗੀ ਹੈ ਜੇ ਤੁਸੀਂ ਪੰਜਾਬ ਤੋਂ ਹੀ ਦਿੱਲੀ ਜਾਣਾ ਹੋਵੇ ਤਾਂ ਤੁਹਾਡੇ ਹਜ਼ਾਰ ਬਾ ਪੰਦਾਰਾਂ ਸੌ ਰੁਪਈਆ ਸਿਰਫ ਯਾਤਰਾ ਦੇ ਲਈ ਜਿਹੜਾ ਤੁਹਾਡਾ ਖਰਚ ਹੋਣਾ ਉਹ ਤੁਹਾਡੀ ਜੇਬ ਦੇ ਵਿੱਚ ਹੋਣਾ ਚਾਹੀਦਾ ਹੈ ਅਤੇ ਜੇ ਇਸ ਤੋਂ ਦੂਰ ਜਾਣਾ ਹੈ ਤਾਂ ਇਸ ਤੋਂ ਵੀ ਵੱਧ ਪੈਸੇ ਜਿਹੜੇ ਉਹ ਤੁਹਾਡੀ ਜੇਬ ਵਿੱਚ ਹੋਣੇ ਚਾਹੀਦੇ ਹਨ ਜਿਸ ਕਰਕੇ ਭਾਰਤ ਵਿੱਚ ਜਿਹੜੀ ਯਾਤਰਾ ਇਹ ਉਹ ਕਾਫੀ ਮਹਿੰਗੀ ਹੈ ਕਿਉਂ ਕਰਕੇ ਇੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਫੀ ਉੱਪਰ ਹਨ ਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ